ਜੀ ਹਾਂ ਮੇਰੇ ਕੋਲ ਇੱਕ ਅਜਿਹੀ ਪੇਂਟਿੰਗ ਹੈ ਜੋ ਮੇਰੇ ਲਈ ਇੰਨੀ ਕ ਜ਼ਿਆਦਾ ਮਹੱਤਵਪੂਰਨ ਹੈ ਅਤੇ ਮੇਰੇ ਨਿੱਜੀ ਅਰਥ ਇੰਨੇ ਜ਼ਿਆਦਾ ਮਹੱਤਵਪੂਰਨ ਰੱਖਦੀ ਹੈ ਉਹ ਮਤਲਬ ਮੇਰੀ ਮੇਰੇ ਅਤੇ ਮੇਰੇ ਹਸਬੈਂਡ ਦੀ ਪੇਂਟਿੰਗ ਹੈ ਜੋ ਕਿ ਮੇਰੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਸ ਦੇ ਪਿੱਛੇ ਜੋ ਕਹਾਣੀ ਹੈ ਉਹ ਇਹ ਹੈ ਕਿ ਮੈਂ ਮੇਰੇ ਅਤੇ ਮੇਰੇ ਪਤੀ ਦੇ ਵਿੱਚ ਇੰਨਾ ਜ਼ਿਆਦਾ ਮੋਹ ਪ੍ਰੇਮ ਦਰਸਾਉਂਦੀ ਹੈ ਅਤੇ ਮੇਰੇ ਲਈ ਬਹੁਤ ਹੀ ਜ਼ਿਆਦਾ ਇਮਪੋਰਟੈਂਟ ਹੈ ਇਸ ਨੂੰ ਦੇਖ ਕੇ ਮੈਨੂੰ ਉਹ ਸਾਰੀਆਂ ਪਿਛਲੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਜੋ ਮਤਲਬ ਉਸ ਸਮੇਂ ਮੈਂ ਉਹਨਾਂ ਨਾਲ ਬਿਤਾਈਆਂ ਹਨ ਅਤੇ ਮੈਨੂੰ ਉਸ ਦਾ ਹਰ ਇੱਕ ਮੂਵਮੈਂਟ ਹਰ ਇੱਕ ਮੂਵਮੈਂਟ ਮੇਰੇ ਦਿਮਾਗ ਵਿੱਚ ਇਨਵੋਲਵ ਹੁੰਦਾ ਹੈ ਅਤੇ ਉਸਨੂੰ ਦੇਖ ਕੇ ਮੇਰੇ ਮੁੱਖ 'ਤੇ ਹਾਸੀ ਆਉਂਦੀ ਹੈ ਅਤੇ ਮੈਂ ਮਤਲਬ ਖੁਸ਼ ਹੁੰਦੀ ਹਾਂ ਇੰਨੀ ਕੁ ਜ਼ਿਆਦਾ ਖੁਸ਼ ਹੁੰਦੀ ਹਾਂ ਅਤੇ ਮੇਰੇ ਦ੍ਰਿਸ਼ਟੀਕੋਣ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਕਿ ਮੈਂ ਉਸ ਪੇਂਟਿੰਗ ਨੂੰ ਦੇਖ ਦੇਖ ਕੇ ਹੀ ਖੁਸ਼ ਹੁੰਦੀ ਰਹਿੰਦੀ ਹਾਂ ਅਤੇ ਮੈਨੂੰ ਉਹ ਪੇਂਟਿੰਗ ਬਹੁਤ ਹੀ ਜ਼ਿਆਦਾ ਪਸੰਦ ਹੈ